ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਮੈਮ ਮੈਂ ਗਰਗ ਬੁੱਕ ਡਿਪੂ ਤੋਂ ਗੱਲ ਕਰ ਰਹੀ ਹਾਂ ਹਾਂਜੀ ਬੁੱਕਸ ਮੈਮ ਸਾਡੇ ਬੁੱਕ ਡੀਪੂ 'ਤੇ ਲਗਭਗ ਸਾਰੇ ਤਰ੍ਹਾਂ ਦੀ ਹੈਗੀਆਂ ਨੇ ਜੇ ਸਾਹਿਤ ਦੀ ਗੱਲ ਕਰੀਏ ਤਾਂ ਪੰਜਾਬੀ ਸਾਹਿਤ ਅੰਗਰੇਜ਼ੀ ਸਾਹਿਤ ਹਿੰਦੀ ਸਾਹਿਤ ਦੀਆਂ ਕਿਤਾਬਾਂ ਹੈਗੀਆਂ ਨੇ ਤੇ ਜਿਹਦੇ ਵਿੱਚ ਮੈਮ ਸਾਰੇ ਤਰ੍ਹਾਂ ਦੇ ਜਿਵੇਂ ਕਹਾਣੀ ਸੰਗ੍ਰਹਿ ਤੁਹਾਨੂੰ ਮਿਲ ਜਾਣਗੇ ਅਤੇ ਨਾਟਕ ਮਿਲ ਜਾਣਗੇ ਆਲੋਚਨਾ ਦੀਆਂ ਕਿਤਾਬਾਂ ਮਿਲ ਜਾਣਗੀਆਂ ਕਾਵ ਸੰਗ੍ਰਹਿ ਮਿਲ ਜਾਣਗੇ ਨਾਵਲ ਮਿਲ ਜਾਣਗੇ ਮੈਮ ਤੋ ਅਂ ਇਸ ਤੋਂ ਇਲਾਵਾ ਜਿਵੇਂ ਮੋਟੀਵੇਸ਼ਨਲ ਕਿਤਾਬਾਂ ਜਾਂ ਕਿਸੇ ਵਿਸ਼ੇਸ਼ ਪੇਪਰ ਅਗਜ਼ਾਮ ਦੀ ਤੁਸੀਂ ਤਿਆਰੀ ਕਰਨੀ ਆ ਉਹਦੇ ਨਾਲ ਸੰਬੰਧਿਤ ਕਿਤਾਬਾਂ ਵੀ ਸਾਡੇ ਕੋਲ ਹੈਗੀਆਂ ਨੇ ਹਾਂਜੀ ਹਾਂਜੀ ਅੱਛਾ ਜੀ ਤਾਂ ਮੈਮ ਜਿਹੜੀ ਹਿੰਦੀ ਦੇ ਨੈਟ ਦੇ ਤਿਆਰੀ ਵਾਸਤੇ ਕਿਤਾਬਾਂ ਨੇ ਤਾਂ ਉਹਦੇ ਲਈ ਸਭ ਤੋਂ ਵਧੀਆ ਕਿਤਾਬ ਦ੍ਰਿਸ਼ਟੀ ਦੀ ਹੈ ਇੱਕ ਤਾਂ ਅਤੇ ਇਸ ਤੋਂ ਇਲਾਵਾ ਅਰੀਹੰਤ ਦੀ ਕਿਤਾਬ ਆ ਇੱਕ ਇੱਕ ਮੈਮ ਗੋਬਿੰਦ ਸਰਸਵਤੀ ਪਾਂਡੇ ਦੀ ਆ ਅਤੇ ਇੱਕ ਮੈਮ ਆਚਾਰੀਆ ਰਾਮ ਚੰਦਰ ਸ਼ੁਕਲ ਦਾ ਇਤਿਹਾਸ ਆ ਡਾਕਟਰ ਨਗੇਂਦਰ ਦਾ ਜਿਹੜਾ ਹਿੰਦੀ ਸਾਹਿਤ ਦਾ ਇਤਿਹਾਸ ਸਾਡੇ ਕੋਲ ਹੈ ਅਤੇ ਆਰ ਗੁਪਤਾ ਦੀ ਕਿਤਾਬ ਆ ਮੈਮ ਇੱਕ ਸਾਡੇ ਕੋਲ ਅਤੇ ਇਹ ਕਿਤਾਬਾਂ ਮੈਮ ਯੂ ਜੀ ਸੀ ਨੈੱਟ ਦੇ ਲਈ ਕਾਫੀ ਨੇ ਅਤੇ ਤੁਹਾਨੂੰ ਪੇਪਰ ਵੈਕਸ 'ਚ ਵੀ ਮਿਲ ਜਾਣਗੀਆਂ ਅਤੇ ਹਾਰਡ ਕਵਰ ਦੇ ਵਿੱਚ ਵੀ ਮਿਲ ਜਾਣਗੀਆਂ ਹਾਂਜੀ ਹਾਂਜੀ ਮੈਮ ਡਿਲੀਵਰੀ ਅਸੀਂ ਕਰ ਦਿਆਂਗੇ ਆਪਣਾ ਤੁਸੀਂ ਅਡਰੈਸ ਭੇਜ ਦਿਓ ਅਤੇ ਅਸੀਂ ਕਰ ਦੇਵਾਂਗੇ ਮੈਮ ਪੇਮੈਂਟ ਦੇ ਸਾਡੇ ਕੋਲ ਦੋਨੇਂ ਮਾਧਿਅਮ ਹੈਗੇ ਨੇ ਜਿਵੇਂ ਤੁਸੀਂ ਔਨਲਾਈਨ ਕਰਨਾ ਚਾਹੋਂ ਤਾਂ ਔਨਲਾਈਨ ਕਰ ਸਕਦੇ ਹੋ ਐਡਵਾਂਸ 'ਚ ਵੀ ਕਰ ਸਕਦੇ ਹੋ ਅਤੇ ਜੇ ਮੈਮ ਤੁਸੀਂ ਕੈਸ਼ ਓਨ ਡਿਲੀਵਰੀ ਕਿਤਾਬਾਂ ਪ੍ਰਾਪਤ ਕਰਨ ਤੋਂ ਬਾਅਦ ਕਰੋਗੇ ਤਾਂ ਉਹ ਵੀ ਕਰ ਸਕਦੇ ਹੋ ਹਾਂਜੀ ਅ ਮੈਮ ਜੇ ਸਾਡੀਆਂ ਕਿਤਾਬਾਂ ਨਾ ਇੱਕ ਹਜ਼ਾਰ ਤੋਂ ਉੱਪਰ ਅਮਾਊਂਟ ਦੀਆਂ ਤੁਸੀਂ ਮੰਗਾਉਂਦੇ ਹੋ ਤਾਂ ਅਸੀਂ ਵੀਹ ਪਰਸੈਂਟ ਡਿਸਕਾਊਂਟ ਦੇਵਾਂਗੇ ਤੁਹਾਨੂੰ ਅਤੇ ਇੱਕ ਮੈਮ ਉਹਦੇ ਨਾਲ ਜਿਹੜਾ ਸਾਡੇ ਵੱਲੋਂ ਕੈਲੰਡਰ ਵੀ ਤੁਹਾਨੂੰ ਫਰੀ ਦੇ ਵਿੱਚ ਦਿੱਤਾ ਜਾਵੇਗਾ ਹਾਂਜੀ ਮੈਮ ਅਤੇ ਜੇ ਮੈਮ ਤੁਸੀਂ ਦੋ ਹਜ਼ਾਰ ਤੋ ਉੱਪਰ ਦੀਆਂ ਕਰਦੇ ਹੋ ਤਾਂ ਉਹਦੇ ਨਾਲ ਅਸੀਂ ਇੱਕ ਡਾਇਰੀ ਵੀ ਤੁਹਾਨੂੰ ਮਤਲਬ ਦੇਵਾਂਗੇ ਫਰੀ ਦੇ ਵਿੱਚ ਹਾਂਜੀ ਹਾਂਜੀ ਹਾਂਜੀ ਮੈਮ ਇਹੀ ਨੰਬਰ ਹੈ ਹਾਂਜੀ ਮੈਮ ਹਾਂਜੀ ਮੈਮ ਲਗਭਗ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੀਆਂ ਕਿਤਾਬਾਂ ਨਾ ਤੁਹਾਨੂੰ ਡਿਲੀਵਰ ਕਰ ਦਿੱਤੀਆਂ ਜਾਣਗੀਆਂ ਅਤੇ ਨਾਲ ਮੈਮ ਇਹ ਵੀ ਮੈਨਸ਼ਨ ਜ਼ਰੂਰ ਕਰ ਦਿਓ ਵੀ ਹਾਰਡ ਕਵਰ ਚਾਹੀਦਾ ਪੇਪਰ ਵੈਕਸ ਚਾਹੀਦੀਆਂ ਹਾਂਜੀ ਮੈਮ ਠੀਕ ਹੈ ਜੀ ਠੀਕ ਹੈ ਜੀ ਓਕੇ